ਸਮੇਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਬਹੁਤ ਬਦਲਾਅ ਆਇਆ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਜੋ ਪੰਜਾਬੀ ਬੱਚੇ ਹਨ ਉਹ ਪੰਜਾਬੀ ਪੜ੍ਹਨਾ ਨਹੀਂ ਚਾਹੁੰਦੇ ਜਾਂ ਫਿਰ ਉਹ ਪੰਜਾਬੀ ਪੜ੍ਹਨ ਵਿੱਚ ਇੰਟਰਸਟ ਨਹੀਂ ਰੱਖਦੇ ਕਿਉਂਕਿ ਅੱਜ ਕੱਲ੍ਹ ਅਸੀਂ ਚੱਲ ਰਹੇ ਹਾਂ ਮੋਡਰਨ ਜਮਾਨੇ ਵੱਲ ਮੋਡਰਨ ਜਮਾਨੇ 'ਚ ਕੀ ਹੋ ਰਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਗਲਿਸ਼ ਵੱਲ ਧੱਕੀ ਚਲ ਰਹੇ ਹਾਂ ਜਿਹਦੇ ਨਾਲ ਬੱਚੇ ਅਸੀਂ ਇੰਗਲਿਸ਼ ਮੀਡੀਅਮ ਸਕੂਲ 'ਚ ਪਾਉਂਦੇ ਪਏ ਹਾਂ ਅਤੇ ਇੰਗਲਿਸ਼ ਸਾਡਾ ਇੱਕ ਸਟੇਟਸ ਸਿਬਲ ਬਣ ਗਿਆ ਅਤੇ ਜਿਹਦੇ ਕਰਕੇ ਬੱਚਿਆਂ ਨੂੰ ਅਸੀਂ ਪੰਜਾਬੀ ਬੋਲਣ ਦਿੰਦੇ ਨਹੀਂ ਹਾਂ ਜੇ ਬੋਲਣੀ ਹੈ ਤਾਂ ਸਿਰਫ ਹਿੰਦੀ ਬੋਲੋ ਜਾਂ ਅੰਗਰੇਜ਼ੀ ਬੋਲੋ ਠੀਕ ਹੈ ਅਤੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਜ਼ਿਆਦਾਤਰ ਇੰਗਲਿਸ਼ ਵੱਲ ਹੀ ਕੀਤਾ ਜਾਂਦਾ ਵੀ ਤੁਸੀਂ ਇੰਗਲਿਸ਼ ਹੀ ਬੋਲਣੀ ਹੈ ਅਤੇ ਬੱਚਿਆਂ ਦਾ ਪ੍ਰਭਾਵ ਇੰਗਲਿਸ਼ ਵੱਲ ਜ਼ਿਆਦਾ ਵੱਧ ਰਿਹਾ ਜਿਸ ਕਰਕੇ ਪੰਜਾਬੀ ਦੀ ਭਾਸ਼ਾ ਦੀ ਵਿੱਚ ਬਦਲਾਓ 'ਚ ਕਾਫੀ ਵ ਵਰਤੋਂ 'ਚ ਕਾਫੀ ਬਦਲਾਅ ਆ ਰਿਹਾ ਕਿਉਂਕਿ ਕੁਛ ਬੱਚੇ ਨੂੰ ਅੱਜ ਕੱਲ੍ਹ ਸਾਡੇ ਜਿਹੜੇ ਕੁਛ ਇੱਦਾਂ ਦੇ ਅੱਖਰ ਹੁੰਦੇ ਨੇ ਪੰਜਾਬੀ ਵਿੱਚ ਪੰਜਾਬੀ ਲਿਖਣੀ ਬੋਲਣੀ ਅਤੇ ਜਾਂ ਫਿਰ ਉਹਨਾਂ ਨੂੰ ਸਮਝ ਨਹੀਂ ਪੜਨੀ ਉਹਨਾਂ ਨੂੰ ਨਹੀਂ ਆ ਰਹੀ ਇਸ ਦਾ ਮੁੱਖ ਕਰਨ ਇੱਕ ਹੋਰ ਹੋ ਸਕਦਾ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਹੋਰ ਸੱਭਿਆਚਾਰਾਂ ਨੇ ਬਹੁਤ ਪ੍ਰਭਾਵ ਪਾਇਆ ਜਿੱਦਾਂ ਕਿ ਸਾਡੇ ਜਿਹੜੇ ਬੱਚੇ ਹੈ ਇੱਥੋਂ ਪੜ੍ਹ ਲਿਖ ਕੇ ਹੋਰ ਸ਼ਹਿਰਾਂ ਵਿੱਚ ਜਾਂ ਹੋਰ ਸਟੇਟਾਂ ਵਿੱਚ ਜਾਂ ਹੋਰ ਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਉੱਥੇ ਪੜ੍ਹਦੇ ਨੇ ਜਿਸ ਕਰਕੇ ਉਹ ਜਿਹੜੇ ਦੂਸਰੇ ਬੱਚੇ ਨੇ ਨਾ ਉਹ ਉਹ ਵੀ ਇਹਨਾਂ ਵੱਲ ਦੇਖ ਕੇ ਅਤੇ ਉਹ ਵੀ ਪੰਜਾਬੀ ਭਾਸ਼ਾ ਨੂੰ ਛੱਡ ਕੇ ਅਤੇ ਦੂਜੀਆਂ ਭ ਭਾਸ਼ਾਵਾਂ ਵੱਲ ਪ੍ਰਭਾਵਿਤ ਹੋ ਰਹੇ ਨੇ ਅਤੇ ਜਿਸ ਦੇ ਕਾਰਨ ਪੰਜਾਬੀ ਭਾਸ਼ਾ ਕਾਫੀ ਪ੍ਰਭਾਵਿਤ ਹੋਈ ਹੈ ਅਤੇ ਤੀਜਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਜਿੱਦਾਂ ਕਿ ਪੰਜਾਬ ਤੋਂ ਹਰਿਆਣਾ ਹਿਮਾਚਲ ਰਾਜਸਥਾਨ ਜਾਂ ਯੂ ਪੀ ਬਿਹਾਰ ਤੋਂ ਬਹੁਤ ਸਾਰੇ ਲੋਕ ਇੱਥੇ ਆ ਕੇ ਵੱਸ ਗਏ ਨੇ ਤੇ ਉਹ ਇੱਥੇ ਆ ਕੇ ਆਪਣੀ ਭਾਸ਼ਾ ਬੋਲਦੇ ਨੇ ਅਤੇ ਸਾਡੇ ਬੱਚੇ ਵੀ ਉਹਨਾਂ ਵੱਲ ਦੇਖ ਕੇ ਉਹ ਉਹੀ ਵੀ ਭਾਸ਼ਾ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਜਾਂ ਫਿਰ ਉਹ ਜਿੱਦਾਂ ਸਕੂਲ ਕਾਲਜ 'ਚ ਬੱਚੇ ਇਕੱਠੇ ਪੜ੍ਹਦੇ ਨੇ ਅਤੇ ਉਹ ਆਪਣੀ ਭਾਸ਼ਾ ਨਾਲ ਮਿਕਸ ਹੁੰਦੇ ਜਾਂਦੇ ਨੇ ਸਾਡੇ ਜਿਹੜੇ ਪਿਓਰ ਵਰਡ ਨੇ ਅਤੇ ਸਾਡੀ ਜਿਹੜੀ ਸਾਫ਼ ਸੁਥਰੀ ਪੰਜਾਬੀ ਸੀਗੀ ਹੁਣ ਉਹ ਸਾਫ਼ ਨਹੀਂ ਰਹਿ ਗਈ ਉਹ 'ਚ ਹੁਣ ਹੋਰ ਨਵੇਂ ਨਵੇਂ ਅੱਖਰ ਮਿਕਸ ਹੁੰਦੇ ਗਏ ਅਤੇ ਜਿਸ ਕਰਕੇ ਸਾਡੇ ਬੱਚੇ ਆਪਣੀ ਹੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਹੁਤ ਘੱਟ ਪੜ੍ਹਾਇਆ ਜਾ ਰਿਹਾ ਸਕੂਲਾਂ ਵਿੱਚ ਜਾਂ ਕੋਲਜਾਂ ਵਿੱਚ ਪੰਜਾਬੀ ਸੱਭਿਆਚਾਰ ਬਾਰੇ ਬੱਚਿਆਂ ਨੂੰ ਦੱਸਿਆ ਹੀ ਨਹੀਂ ਜਾਂਦਾ ਜੇ ਦੱਸਿਆ ਜਾਂਦਾ ਸਿਰਫ਼ ਕਿਤਾਬਾਂ ਵਿੱਚ ਜਿੰਨਾ ਕੁ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਅਤੇ ਜਿਸ ਕਰਕੇ ਬੱਚਿਆਂ ਨੂੰ ਸਾਡੇ ਸੱਭਿਆਚਾਰ ਬਾਰੇ ਕੁਛ ਪਤਾ ਹੀ ਨਹੀਂ ਲੱਗ ਰਿਹਾ ਅਤੇ ਜਿਸ ਕਰਕੇ ਪੰਜਾਬੀ ਭਾਸ਼ਾ ਪ੍ਰਭਾਵਿਤ ਹੋ ਰਹੀ ਹੈ